ਮੈਨੂੰ ਡਾਂਸ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਸੀ ਜਦੋਂ ਮੈਂ ਡਾਂਸ ਕਰਨਾ ਸਿੱਖਿਆ ਸੀ ਤਦ ਮਤਲਬ ਮੇਰੇ ਘਰਦਿਆਂ ਨੂੰ ਪਤਾ ਸੀ ਕਿ ਮੈਨੂੰ ਡਾਂਸ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਡਾਂਸ ਮੈਨੂੰ ਮੇਰੇ ਘਰਦਿਆਂ ਨੇ ਡਾਂਸ ਸਿੱਖਣ ਦੇ ਲਈ ਡਾਂਸ ਦੇ ਵਿੱਚ ਮੈਨੂੰ ਗਿੱਧਾ ਕਰਨਾ ਪਸੰਦ ਸੀਗਾ ਅਤੇ ਮੇਰੇ ਘਰਦਿਆਂ ਨੇ ਮੈਨੂੰ ਡਾਂਸ ਸਿੱਖਣ ਦੇ ਲਈ ਅਕੈਡਮੀ ਦੇ ਵਿੱਚ ਲਗਾਇਆ ਅਤੇ ਮੈਂ ਉੱਥੇ ਆਪਣਾ ਗਿੱਧਾ ਸਿੱਖਿਆ ਗਿੱਧਾ ਸਿੱਖਦੀ ਸਿੱਖਦੀ ਨੇ ਮੈਂ ਮਤਲਬ ਕਾਫੀ ਮਤਲਬ ਗਿੱਧੇ ਦੇ ਵਿੱਚ ਪਰਫੋਰਮੈਂਸ ਦੇ ਵਿੱਚ ਆਪਣਾ ਵਧੀਆ ਕੀਤਾ ਅਤੇ ਜਦੋਂ ਮਤਲਬ ਮੈਂ ਕੋਲੇਜ ਦੇ ਵਿੱਚ ਪੜ੍ਹਦੀ ਸੀ ਅਤੇ ਮੈਨੂੰ ਕੋਲੇਜ ਦੇ ਵਿੱਚ ਪੜ੍ਹਦਿਆਂ ਪੜ੍ਹਦਿਆਂ ਮਤਲਬ ਆਪਣੇ ਜੂਨੀਅਰਜ ਨੂੰ ਮਤਲਬ ਸਿਖਾਉਣ ਦਾ ਇੱਕ ਵਾਰ ਮੌਕਾ ਮਿਲਿਆ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਚੁੱਕੀ ਸੀ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਜਦੋਂ ਮੈਂ ਪ ਪੋਸਟ ਗ੍ਰੈਜੂਏਟ ਵਿੱਚ ਹੋਈ ਸੀ ਮਤਲਬ ਅਜੇ ਮੇਰਾ ਫ ਮਤਲਬ ਪਹਿਲਾ ਹੀ ਈਅਰ ਸੀ ਫਸਟ ਸੈਮ ਸੀ ਅਤੇ ਫਸਟ ਸੈਮ ਦੇ ਵਿੱਚ ਜਦੋਂ ਮੈਂ ਹੋਈ ਤਦ ਮੈਨੂੰ ਗਿੱਧਾ ਸਿਖਾਉਣ ਦਾ ਮੌਕਾ ਮਿਲਿਆ ਅਤੇ ਕਿਉਂਕਿ ਉਸ ਟਾਈਮ ਇਹ ਸੀ ਕਿ ਯੂਥ ਫੈਸਟੀਵਲਸ ਚੱਲ ਰਹੇ ਸੀ ਯੂਥ ਫੈਸਟੀਵਲ ਚੱਲ ਰਹੇ ਸੀ ਅਤੇ ਮੈਂ ਕਈ ਪਿਛਲੀ ਵਾਰ ਮਤਲਬ ਜਦੋਂ ਮੈਂ ਗ੍ਰੈਜੂਏਸ਼ਨ ਦੇ ਵਿੱਚ ਸੀਗੀ ਤਾਂ ਮੈਂ ਯੂਥ ਫੈਸਟੀਵਲ ਦੇ ਵਿੱਚ ਸਾਡੀ ਟੀਮ ਦੀ ਟਰੋਫੀ ਆਈ ਸੀ ਅਤੇ ਸਾਡੀ ਫਸਟ ਪੁਜ਼ੀਸ਼ਨ ਆਈ ਸੀ ਉਹ ਪਹਿਲੀ ਪੁਜੀਸ਼ਨ ਆਉਣ ਦੇ ਕਰਕੇ ਸਾਨੂੰ ਕਿਆ ਹੈ ਜੋ ਗਿੱਧਾ ਸੀਗਾ ਆਉਂਦਾ ਸੀਗਾ ਅਤੇ ਸਾਨੂੰ ਸਾਡੇ ਟੀਚਰਸ ਵੱਲੋਂ ਅਪੀਲ ਕੀਤੀ ਗਈ ਕਿ ਗਿੱਧੇ ਦਾ ਕੋਈ ਟੀਚਰ ਨਹੀਂ ਹੈ ਅਤੇ ਅਸੀਂ ਉਹ ਜਿਹੜਾ ਗਿੱਧਾ ਹੈ ਬੱਚਿਆਂ ਨੂੰ ਸਿਖਾਈਏ ਅਤੇ ਅਸੀਂ ਬੱਚਿਆਂ ਨੂੰ ਗਿੱਧਾ ਸਿਖਾਇਆ ਵੀ ਬੱਚਿਆਂ ਨੂੰ ਨਹੀਂ ਕਹਿ ਸਕਦੇ ਕਿ ਕੋਲੇਜ ਦੇ ਬੱ ਸਟੂਡੈਂਟਸ ਜੋ ਹੁੰਦੇ ਆ ਉਹ ਬੱਚੇ ਨਹੀਂ ਹੁੰਦੇ ਹੈ ਕੁੜੀਆਂ ਨੂੰ ਗਿੱਧਾ ਸਿਖਾਉਣ ਦਾ ਮੌਕਾ ਮਿਲਿਆ ਉਹ ਕੁੜੀਆਂ ਗਿੱਧਾ ਪਹਿਲਾਂ ਹੀ ਵਧੀਆ ਕਰਦੀਆਂ ਸੀ ਅਤੇ ਅਸੀਂ ਉਹਨਾਂ ਨੂੰ ਹੋਰ ਸਿਖਾਇਆ ਇਹ ਅਨੁਭਵ ਜੋ ਸੀ ਇਹ ਬਹੁਤ ਜ਼ਿਆਦਾ ਵਧੀਆ ਸੀ ਪਰ ਜਦੋਂ ਅਸੀਂ ਕਿਸੇ ਨੂੰ ਵੀ ਕੋਈ ਚੀਜ਼ ਸਿਖਾਉਂਦੇ ਹਾਂ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਪਰ ਇਸ ਦੇ ਨਾਲ ਮਿਹਨਤ ਵੀ ਬਹੁਤ ਲੱਗਦੀ ਹੈ ਅਸੀਂ ਬਹੁਤ ਮਤਲਬ ਮੈਂ ਬਹੁਤ ਮਿਹਨਤ ਕੀਤੀ ਉਹਨਾਂ ਨੂੰ ਬਹੁਤ ਸਿਖਾਇਆ ਉਹਨਾਂ ਨੂੰ ਮਤਲਬ ਉਹਨਾਂ ਨੂੰ ਗਿੱਧਾ ਆਉਂਦਾ ਤਾਂ ਸੀ ਪਰ ਉਹਨਾਂ ਦੇ ਕਦੇ ਵੀ ਸਟੈਪ ਜੋ ਸੀ ਉਹ ਕਦੇ ਵੀ ਮੈਚ ਨਹੀਂ ਕਰਦੇ ਸੀ ਉਹ ਸਟੈਪ ਮੈਚ ਕਰਨ ਦੇ ਲਈ ਜੋ ਜੋ ਮਿਹਨਤ ਲੱਗਦੀ ਸੀ ਉਹਨਾਂ ਨੂੰ ਵਾਰ ਵਾਰ ਵਾਰ ਵਾਰ ਉਹੀ ਸਟੈਪ ਕਰਵਾਉਣੇ ਅਤੇ ਸਟੈਪ ਕਰਵਾ ਕੇ ਉਹਨਾਂ ਦੀ ਜਿਹੜੀ ਪਰਫੋਰਮੈਂਸ ਹੈ ਵਧੀਆ ਕਰਵਾਉਣੀ ਪਹਿਲਾਂ ਇੱਕ ਵਾਰ ਤਾਂ ਅਜਿਹਾ ਵੀ ਹੋਇਆ ਕਿ ਉਹਨਾਂ ਨੂੰ ਸਿਖਾਇਆ ਗਿਆ ਅਤੇ ਉਹਨਾਂ ਨੂੰ ਕੋਲੇਜ ਦੇ ਸਾਹਮਣੇ ਮਤਲਬ ਆਪਣੇ ਕੋਲੇਜ ਦੇ ਸਾਹਮਣੇ ਹੀ ਪ੍ਰਫੋਰਮੈਂਸ ਦੇ ਲਈ ਸਟੇਜ 'ਤੇ ਭੇਜਿਆ ਗਿਆ ਪਰ ਉਹਨਾਂ ਦੇ ਜੋ ਸਟੈਪ ਸੀਗੇ ਉਹ ਮੈਚ ਨਹੀਂ ਹੋ ਪਾ ਰਹੇ ਥੇ ਸਟੈਪ ਮੈਚ ਨਾ ਹੋਣ ਦੇ ਕਰਕੇ ਪ੍ਰਿੰਸੀਪਲ ਨੇ ਕਿਹਾ ਕਿ ਨਹੀਂ ਉਹ ਗੱਲ ਨਹੀਂ ਬਣਦੀ ਹੈ ਇਸ ਲਈ ਹੋਰ ਮਿਹਨਤ ਕਰੋ ਪਰ ਦਿਨ ਥੋੜ੍ਹੇ ਬਚੇ ਹੋਏ ਸੀ ਕੋਈ ਵਧੀਆ ਟੀਚਰ ਨਾ ਹੋਣ ਕਰਕੇ ਮਤਲਬ ਸਾਨੂੰ ਕਿਹਾ ਗਿਆ ਸੀ ਅਤੇ ਅਸੀਂ ਆਪਣੇ ਟੀਚਰਸ ਦੀ ਰੈਪੂਰੇਸ਼ਨ ਵੀ ਬਚਾਉਣੀ ਸੀ ਇਸ ਲਈ ਜੋ ਦਿਨ ਸੀ ਜੋ ਉਹ ਸੀ ਨੇੜੇ ਆਉਂਦਾ ਗਿਆ ਅਤੇ ਅਸੀਂ ਹੋਰ ਵਧੀਆ ਉਹਨਾਂ ਨੂੰ ਮਿਹਨਤ ਕਰਵਾਈ ਉਹ ਸਿਖਾਉਣ ਦਾ ਮੌਕਾ ਸਾਡੇ ਲਈ ਵੀ ਮਤਲਬ ਥੋੜ੍ਹਾ ਅਨੁਭਵੀ ਸੀ ਕਿਉਂਕਿ ਅਸੀਂ ਅਜਿਹਾ ਕਦੇ ਕੀਤਾ ਨਹੀਂ ਸੀ ਅਤੇ ਜਦੋਂ ਅਸੀਂ ਉਹਨਾਂ ਨੂੰ ਗਿੱਧਾ ਸਿਖਾਇਆ ਉਹਨਾਂ ਨੇ ਕੀਤਾ ਕਿਉਂਕਿ ਉਹਨਾਂ ਪਰ ਵੀ ਇੱਕ ਪ੍ਰੈਸ਼ਰ ਬਣ ਗਿਆ ਸੀ ਕਿ ਹਾਂ ਅਸੀਂ ਕਰਨਾ ਹੈ ਅਸੀਂ ਪੋਜਿਸਨ ਲੈ ਕੇ ਆਉਣੀ ਹੈ ਅਤੇ ਉਹਨਾਂ ਨੇ ਜਦੋਂ ਸੋਚਿਆ ਕਿ ਹਾਂ ਅਸੀਂ ਇਹ ਪੋਜ਼ੀਸ਼ਨ ਲੈ ਕੇ ਆਉਣੀ ਹੈ ਅਤੇ ਉਹ ਪੁਜ਼ੀਸ਼ਨ ਲੈ ਕੇ ਵੀ ਆਏ ਅਤੇ ਉਹਨਾਂ ਦੀ ਪਹਿਲੀ ਪੁਜੀਸ਼ਨ ਤਾਂ ਨਹੀਂ ਆ ਪਾਈ ਪਰ ਉਹਨਾਂ ਦੀ ਦੂਜੀ ਪੁਜ਼ੀਸ਼ਨ ਆਈ ਅਤੇ ਯੂਥ ਫੈਸਟੀਵਲ ਦੀ ਦੂਜੀ ਟਰੋਫੀ ਸਾਡੇ ਕੋਲੇਜ ਦੇ ਨਾਮ ਆਈ ਅਤੇ ਪਹਿਲੀ ਨਾ ਆਉਣ ਦੇ ਕਰਕੇ ਸਾਨੂੰ ਕੋਈ ਗਮੀ ਨਹੀਂ ਹੋਈ ਪਰ ਸਾਨੂੰ ਖੁਸ਼ੀ ਬਹੁਤ ਹੋਈ ਕਿ ਹਾਂ ਸਾਡੀ ਟੀਮ ਦੀ ਕੋਈ ਤਾਂ ਪੁਜ਼ੀਸ਼ਨ ਆਈ ਹੈ ਨਾ ਅਤੇ ਉਹ ਖੁਸ਼ੀ ਮਤਲਬ ਕਿਹਾ ਜਾ ਸਕਦਾ ਕਿ ਬਹੁਤ ਜ਼ਿਆਦਾ ਵੱਡੀ ਸੀਗੀ ਸਾਡੇ ਲਈ ਮਤਲਬ ਮੇਰੇ ਲਈ ਤਾਂ ਵੱਡੀ ਸੀ ਕਿਉਂਕਿ ਮੈਂ ਉਹਨਾਂ ਨੂੰ ਸਿਖਾਇਆ ਸੀ ਮੈਂ ਉਹਨਾਂ ਦੀ ਟੀਚਰ ਸੀ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਮਿਹਨਤ ਕੀਤੀ ਸੀ ਅਤੇ ਬਹੁਤ ਜ਼ਿਆਦਾ ਵਧੀਆ ਪਰਫੋਰਮੈਂਸ ਦਿੱਤੀ ਸੀਗੀ ਯੂਥ ਫੈਸਟੀਵਲ ਵਾਲੇ ਦਿਨ ਉਹਨਾਂ ਨਾਲੋਂ ਜ਼ਿਆਦਾ ਮਤਲਬ ਮੈਨੂੰ ਟੈਂਸ਼ਨ ਸੀ ਮੈਨੂੰ ਸੀਗਾ ਕਿ ਉਹ ਵਧੀਆ ਕਰੇ ਅਤੇ ਇਹ ਅਨੁਭਵ ਮਤਲਬ ਬਹੁਤ ਜ਼ਿਆਦਾ ਵਧੀਆ ਵੀ ਸੀ ਬਹੁਤ ਜ਼ਿਆਦਾ ਦਿਲ ਦਿਲ ਧੜਕਾਉਣ ਵਾਲਾ ਵੀ ਸੀ ਅਤੇ ਇਹ ਜਿਹੜਾ ਅਨੁਭਵ ਸੀਗਾ ਬਹੁਤ ਵਧੀਆ ਸੀਗਾ ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਅਜਿਹਾ ਜਿਹੜਾ ਅਨੁਭਵ ਹੈ ਫਿਰ ਕਦੇ ਦੇਖਣ ਨੂੰ ਨਾ ਮਿਲੇ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਮੇਰੇ ਪਰ ਡਿਪਰੈਸ਼ਨ ਬਣਿਆ ਰਹੇ ਕਿ ਹਾਂ ਵਧੀਆ ਕਰੇ ਵਧੀਆ ਕਰੇ ਮੇਰੀ ਕੁ ਮੇਰਾ ਨਾਮ ਹੈ ਚੱਲ ਰਿਹਾ ਕਿ ਹਾਂ ਇਹ ਸਿਖਾ ਰਹੀ ਸੀ ਇਸ ਲਈ ਹੁੰਦਾ ਥੋੜ੍ਹਾ ਪਰ ਮੈਂ ਨਹੀਂ ਚਾਹੁੰਦੀ ਕਿ ਮੈ ਅੱਗੇ ਕਿਸੇ ਨੂੰ ਸਿਖਾਵਾਂ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਅਤੇ ਮੇਰਾ ਇੰਨਾਂ ਮਿਹਨਤ ਮੈਂ ਕਰ ਨਹੀਂ ਸਕਦੀ ਹਾਂ ਇਸ ਲਈ ਜੋ ਵੀ ਮੈਂ ਸਿਖਾਇਆ ਉਹਨਾਂ ਦੀ ਪੁਜੀਸ਼ਨ ਆਈ ਵਧੀਆ ਗੱਲ ਹੈ ਪਰ ਮੈਂ ਅਜਿਹਾ ਅਨੁਭਵ ਮਤਲਬ ਵਧੀਆ ਅਨੁਭਵ ਸੀ ਪਰ ਮੈਂ ਅੱਗੇ ਨਹੀਂ ਕਰਨਾ ਚਾਹੁੰਦੀ